ਮੋਹਾਲੀ ਜ਼ਿਲ੍ਹੇ ਦੇ ਵਿੱਚ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਉੱਪਲਬਧ ਹਨ ਜਿੱਦਾਂ ਪਾਰਕ ਖੇਡ ਥੀਏਟਰ ਔਰ ਸੱਭਿਆਚਾਰਕ ਪ੍ਰੋਗਰਾਮ ਬਹੁਤ ਕਰਵਾਏ ਜਾਂਦੇ ਹਨ ਉੱਥੇ ਸਾਡੇ ਨੇੜੇ ਜਾਂ ਮੋਹਾਲੀ ਦੇ ਵਿੱਚ ਮੂਵੀ ਥੀਏਟਰ ਬਹੁਤ ਸਾਰੇ ਹਨ ਪੀ ਵੀ ਆਰ ਵੀ ਆਰ ਪੰਜਾਬ ਦੇ ਵਿੱਚ ਹੈ ਅਲਾਂਟੇ ਮੋਲ ਵਿੱਚ ਬਹੁ ਲੋਕ ਆਪਣੀ ਮਨਪਸੰਦ ਆਪਣੀ ਫੇਵਰਟ ਮੂਵੀ ਦੇਖਣ ਜਾ ਸਕਦੇ ਹੈ ਮੋਹਾਲੀ ਜ਼ਿਲ੍ਹੇ ਵਿੱਚ ਕ੍ਰਿਕਟ ਖੇਡ ਸਟੇਡੀਅਮ ਵੀ ਹੈ ਔਰ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਮੋਟੀਵੇਟ ਕੀਤਾ ਜਾਂਦਾ ਹੈ ਕਿ ਉਹ ਖੇਡ ਪ੍ਰਤੀ ਆਪਣਾ ਇੰਨਟਰਸਟ ਲੈਣ ਬਜ਼ੁਰਗ ਬੱਚੇ ਇਹਨਾਂ ਦੀ ਸਹੂਲਤ ਲਈ ਪਾਰਕਾਂ ਦੀ ਫੈਸੀਲਿਟੀ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਔਰ ਬਾਗਵਾਨੀ ਬਹੁਤ ਅੱਛੀ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿੱਥੇ ਲੋਕ ਘੁੰਮ ਫਿਰ ਸਕਦੇ ਆਪਣਾ ਜਿਹੜਾ ਵਿਹਲਾ ਟਾਈਮ ਹੈ ਆਪਣੀ ਹੈਲਥ ਦੇ ਰੀਗਾਰਡਿੰਗ ਕੋਈ ਵੀ ਇਸ਼ੂ ਹੈ ਉਸ ਨੂੰ ਠੀਕ ਕਰਨ ਦੇ ਲਈ ਉਹ ਉੱਥੇ ਸੈਰ ਕਰਦੇ ਹੈ ਬੱਚੇ ਲਈ ਸਵਿੰਗਜ਼ ਵਗੈਰਾ ਲਗਾਏ ਹੁੰਦੇ ਹੈ ਇਹਨਾਂ ਨੂੰ ਇ ਇੱਥੇ ਘੁੰਮਣ ਦੇ ਲਈ ਕੋਈ ਅ ਕਿਸੇ ਤਰ੍ਹਾਂ ਦਾ ਇਹ ਪੈਸੇ ਨਹੀਂ ਦੇਣੇ ਪੈਂਦੇ ਇਹ ਸਾਰੀਆਂ ਮੁਫ਼ਤ ਦੇ ਵਿੱਚ ਹੁੰਦੀਆਂ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸਟੇਡੀਅਮ ਥੀਏਟਰ ਹੈਗੇ ਨੇ ਜਿੱਥੇ ਅਸੀਂ ਆਪਣਾ ਵਿਹਲਾ ਟਾਈਮ ਵੀ ਕੰਨਜ਼ਿਊਮ ਕਰ ਸਕਦੇ